ਇੱਕ ਖੂਹ ਤੋਂ ਪਾਣੀ ਕੱਢਣ ਦੇ ਲਈ ਇਲੈਕਟਰਿਕ ਮੋਟਰ ਦੀ ਵਰਤੋਂ ਬਹੁਤ ਹੀ ਪ੍ਰਭਾਵਸ਼ਾਲੀ ਆ ਅਤੇ ਆਸਾਨ ਤਰੀਕਾ ਹੈ ਇਹ ਪ੍ਰਕਿਰਿਆ ਸਧਾਰਨ ਤੌਰ 'ਤੇ ਕੁਝ ਮੁੱਖ ਹਿੱਸਿਆਂ ਦੇ ਨਿਰਭਰ ਕਰਦੀ ਹੈ ਜਿਵੇਂ ਕਿ ਇਲੈਕਟਰੀਕ ਮੋਟਰ ਪੰਪ ਅਤੇ ਪਾਈਪ ਲੈਨ ਸੀਮੇਂਟ ਪਹਿਲਾਂ ਸਹੀ ਕਿਸਮ ਦੇ ਪੰਪ ਨੂੰ ਚੁਣਨਾ ਮਹੱਤਵਪੂਰਨ ਹੈ ਜੋ ਖੂਹ ਦੀ ਗਹਿਰਾਈ ਅਤੇ ਪਾਣੀ ਦੇ ਬਹਾ ਦੇ ਅਨੁਸਾਰ ਸੁਚੇਤ ਹੋਵੇ ਇਲੈਕਟਰਿਕ ਮੋਟਰ ਨੂੰ ਇਸ ਪੰਪ ਨਾਲ ਜੋੜਨਾ ਹੁੰਦਾ ਹੈ ਜੋ ਕਿ ਪੰਪ ਨੂੰ ਚਲਾਉਂਦਾ ਹੈ ਅਤੇ ਪਾਣੀ ਨੂੰ ਖੂਹ ਵਿੱਚੋਂ ਬਾਹਰ ਨਿਕਾਲਦਾ ਹੈ ਮੂ ਮੋਟਰ ਦੀ ਚੁਨਾਈ ਵਿੱਚ ਇਸ ਦੀ ਪਾਵਰ ਰੇਟਿੰਗ ਅਤੇ ਖੂਹ ਦੀ ਗਹਿਰਾਈ ਦੇ ਨਾਲ ਨਾਲ ਪੰਪ ਦੀ ਸਮਰਥਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਲੈਕਟਰਿਕ ਮੋਟਰ ਨੂੰ ਪੰਜਾਬ ਦੇ ਨਾਲ ਜੋੜਨ ਦੇ ਲਈ ਸਧਾਰਨ ਤੌਰ 'ਤੇ ਡਰਾਈਵਰਸ ਸਟਾਫ ਅਤੇ ਬੈਲਟ ਸੀਮਿੰਟ ਦੀ ਵਰਤੋਂ ਕੀਤੀ ਜਾਂਦੀ ਹੈ ਮੋਟਰ ਦੇ ਚਾਲੂ ਕਰਨ 'ਤੇ ਇਸ ਦੀ ਰੇਟਿੰਗ ਗਤੀ ਪੰਪ ਨੂੰ ਚਲਾਉਂਦੀ ਹੈ ਜੋ ਖੂਹ ਦੇ ਅੰਦਰ ਪਾਣੀ ਨੂੰ ਖਿੱਚਦੀ ਹੈ ਅਤੇ ਉੱਪਰ ਪ੍ਰਭਾਵਿਤ ਕਰਦੀ ਹੈ ਪਾਣੀ ਖਿੱਚਣ ਵਾਲੇ ਪੰਪ ਵਿੱਚ ਆਮ ਤੌਰ 'ਤੇ ਇੱਕ ਇੱਕ ਪਾਈਪ ਅਤੇ ਇੱਕ ਡਿਸਚਾਰਜ ਪਾਈਪ ਹੁੰਦੀ ਹੈ ਇਹ ਟਿਕਟ ਪਾਈਪ ਖੂਹ ਤੋਂ ਪਾਣੀ ਨੂੰ ਪੰਪ ਵਿੱਚ ਲਿਆਉਂਦਾ ਹੈ ਜਦੋਂ ਕਿ ਡਿਸਚਾਰਜ ਪਾਈਪ ਪਾਣੀ ਨੂੰ ਖੂਹ ਤੋਂ ਬਹੁਤ ਪਰਵਾਹਿਤ ਕਰਦਾ ਹੈ ਇਹੀ ਸੀਮਿੰਟ ਸਹੀ ਤਰੀਕੇ ਨਾਲ ਕੰਮ ਕਰਨ ਲਈ ਸਹੀ ਇਸ਼ਾਲੇਸ਼ਨ ਅਤੇ ਰਿਚਾਰਮੈਂਟ ਪਰਿਸਿਰਜਰ ਦੀ ਲੋੜ ਹੁੰਦੀ ਹੈ ਤਾਂ ਜੋ ਪੰਪ ਵਧੀਆ ਗੁਜਰ ਹੁਣ ਦਿਖਾ ਸਕੇ ਅਤੇ ਪਾਣੀ ਦੇ ਨਿਕਾਸ ਵਿੱਚੋਂ ਕੋਈ ਰੁਕਾਵਟ ਨਾ ਆਵੇ ਇਸ ਪ੍ਰਕਿਰਿਆ ਵਿੱਚ ਇਹ ਯਕੀਨੀ ਬਣਾਉਂਦਾ ਜ਼ਰੂਰੀ ਹੈ ਕਿ ਪੰਪ ਅਤੇ ਮੋਟਰ ਦੀ ਨਿਸਮਤ ਸੇਵਾ ਅਤੇ ਮੈਟੀਨੈਸ਼ ਕੀਤੀ ਜਾਵੇ ਮੀਟਰ ਮੋਟਰ ਨੂੰ ਸਮੇਂ ਸਮੇਂ 'ਤੇ ਚੈੱਕ ਕਰਨਾ ਜ਼ਰੂਰੀ ਕਰਨਾ ਹੈ ਹੀ ਸੀਮਿੰਟ ਦੀ ਲੰਬ ਲੰਬੇ ਸਮੇਂ ਤੱਕ ਕੁਸ਼ਲਤਾ ਅਤੇ ਭਰੋਸਾ ਯੋਗਤਾ ਬਣੀ ਰਹੇਗੀ ਇਸ ਤਰੀਕੇ ਨਾਲ ਇਲੈਕਟਰਨ ਮੋਟਰ ਦੇ ਜ਼ਰੀਏ ਪਾਣੀ ਕੱਢਣ ਦੀ ਪ੍ਰਕਿਰਿਆ ਸੁਚੇਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ